ਪਟਿਆਲਾ ਸ਼ਹਿਰ ਵਿੱਚ ਰਿਹਾਇਸ਼ੀ ਵਿਕਲਪ ਕਾਫੀ ਉਪਲਬਧ ਹਨ ਇਹਨਾਂ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਕੁਛ ਇੱਕ ਕਲੋਨੀਆਂ ਪੁੱਡਾ ਅਪਰੂਵਡ ਜਾਂ ਪੁੱਡਾ ਦੀਆਂ ਹਨ ਜਿਵੇਂ ਕਿ ਅਰਬਨ ਸਟੇਟ ਫੇਸ ਵੰਨ ਟੂ ਅਤੇ ਥ੍ਰੀ ਇਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਘਰ ਹਨ ਜਿਵੇਂ ਕਿ ਸੋ ਗਜ ਦੇ ਘਰ ਦੋ ਡੇਢ ਸੌ ਗਜ ਦੇ ਘਰ ਅਤੇ ਦੋ ਸੌ ਗਜ ਦੇ ਘਰ ਪੰਜ ਸੌ ਗਜ ਦੇ ਘਰ ਢਾਈ ਸੌ ਗਜ ਦੇ ਘਰ ਤਾਂ ਇਹਨਾਂ ਦੇ ਹਿਸਾਬ ਦੇ ਨਾਲ ਹੀ ਇੱਥੇ ਤੁਹਾਨੂੰ ਇਕੱਲੇ ਰਿਹਾਇਸ਼ੀ ਰੈਂਟ 'ਤੇ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਹਨੂੰ ਘਰ ਵੀ ਉਪਲਬਧ ਹੋ ਸਕਦੇ ਹਨ ਛੋਟੇ ਘਰਾਂ ਦਾ ਅਗਰ ਤੁਸੀਂ ਕਿਰਾਇਆ ਲਗਾਓ ਤਾਂ ਸੌ ਗਜ ਦੇ ਮਕਾਨ ਦਾ ਸੱਤ ਤੋਂ ਅੱਠ ਹਜਾਰ ਰੁਪਇਆ ਕਿਰਾਇਆ ਹੈ ਅਗਰ ਤੁਸੀਂ ਵੱਡਾ ਘਰ ਲੈਣਾ ਹੈ ਤਾਂ ਦਸ ਤੋਂ ਬਾਰਾਂ ਹਜ਼ਾਰ ਪੰਦਰਾਂ ਹਜ਼ਾਰ ਦੋ ਸੌ ਤੋਂ ਢਾਈ ਸੌ ਗਜ ਵਾਲੇ ਘਰ ਦਾ ਕਿਰਾਇਆ ਜਿਹੜਾ ਹੈਗਾ ਉਹ ਪੰਦਰਾਂ ਹਜ਼ਾਰ ਵੀਹ ਹਜ਼ਾਰ ਵੀ ਹੋ ਸਕਦਾ ਹੈ ਇਹ ਘਰ ਦੀ ਬਣਤਰ ਅਤੇ ਸੁਵਿਧਾ ਦੇ ਉੱਪਰ ਵੀ ਨਿਰਭਰ ਕਰਦਾ ਹੈ ਇਸ ਤੋਂ ਸਿਵਾ ਅਗਰ ਤੁਸੀਂ ਇੱਕ ਸਿਰਫ ਇੱਕ ਘਰ ਦੇ ਵਿੱਚ ਜੋ ਕਿ ਉਹਨਾਂ ਦੇ ਓਨਰ ਵੀ ਨਾਲ ਰਹਿ ਰਹੇ ਹਨ ਤੁਸੀਂ ਇੱਕ ਸਿੰਗਲ ਰੂਮ ਵੀ ਲੈਣਾ ਹੈ ਤਾਂ ਦੋ ਹਜ਼ਾਰ ਤਿੰਨ ਹਜ਼ਾਰ ਜਾਂ ਪੰਜ ਹਜ਼ਾਰ 'ਤੇ ਵੀ ਮਿਲ ਸਕਦਾ ਹੈ ਅਗਰ ਤੁਸੀਂ ਪੁੱਡਾ ਦੀਆਂ ਇਹਨਾਂ ਕਲੋਨੀਆਂ ਤੋਂ ਸਿਵਾ ਇਹਨਾਂ ਦੇ ਨਾਲ ਲੱਗਦੀਆਂ ਕੁਛ ਕਲੋਨੀਆਂ ਦੇ ਵਿੱਚ ਚਲੇ ਜਾਓ ਤਾਂ ਤੁਹਨੂੰ ਕੁਛ ਘੱਟ ਰੇਟ 'ਤੇ ਵੀ ਇਹੋ ਜਿਹੀ ਸੁਵਿਧਾ ਪ੍ਰਾਪਤ ਹੋ ਸਕਦੀ ਹੈ ਇਹਨਾਂ ਕਲੋਨੀਆਂ ਦੇ ਵਿੱਚ ਅਗਰ ਤੁਸੀਂ ਰੇਟਾਂ ਦੀ ਗੱਲ ਕਰੋ ਤਾਂ ਛੋਟੇ ਘਰ ਜਿਹੜੇ ਨੇ ਉਹ ਪੰਜ ਕੁ ਹਜ਼ਾਰ ਦੇ ਵੀ ਮਿਲ ਸਕਦਾ ਹੈ ਅੱਠ ਹਜ਼ਾਰ ਦੇ ਵਿੱਚ ਵੀ ਮਿਲ ਸਕਦਾ ਹੈ ਇਸ ਦੇ ਨਾਲ ਹੀ ਵੱਡੇ ਘਰ ਜਿਹੜੇ ਹਨ ਜਿਹੜੇ ਕਿ ਪੁੱਡਾ ਦੀ ਕਲੋਨੀ ਦੇ ਅੰਦਰ ਵੀਹ ਹਜ਼ਾਰ ਤੱਕ ਮਿਲਦੇ ਹਨ ਉਹ ਬਾਹਰ ਤੁਹਾਨੂੰ ਹੋ ਸਕਦਾ ਹੈ ਬਾਰਾਂ ਜਾਂ ਦਸ ਹਜ਼ਾਰ ਦੇ ਵਿੱਚ ਵੀ ਮਿਲ ਜਾਵੇ ਅਸਲ ਵਿੱਚ ਕਿਸੇ ਵੀ ਘਰ ਦਾ ਜਿਹੜਾ ਰੈਂਟ ਹੈ ਉਹ ਉਸ ਘਰ ਦੀ ਬਣਤਰ ਉਹ ਕਦੋਂ ਦਾ ਬਣਿਆ ਹੈ ਅਤੇ ਉਹਦੇ ਵਿੱਚ ਕੀ ਕੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ ਉਹਦੇ ਉੱਪਰ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਅਗਰ ਤੁਸੀਂ ਰਿਅਲ ਅਸਟੇਟ ਦੀ ਗੱਲ ਕਰੋ ਤਾਂ ਦੁਕਾਨਾਂ ਅਗਰ ਤਾਂ ਪੁੱਡਾ ਦੀ ਮਾਰਕੀਟ ਦੀਆਂ ਦੁਕਾਨਾਂ ਹਨ ਤਾਂ ਉਹਨਾਂ ਦੇ ਕਿਰਾਏ ਦਸ ਹਜ਼ਾਰ ਤੋਂ ਉੱਪਰ ਹੀ ਹੋਣਗੇ ਦਸ ਪੰਦਰਾਂ ਵੀਹ ਹਜ਼ਾਰ ਵੱਡੇ ਸ਼ੋ ਰੂਮਾਂ ਦਾ ਤਾਂ ਉਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ ਇਸ ਤੋਂ ਸਿਵਾ ਅਗਰ ਤੁਸੀਂ ਇੱਕ ਆਮ ਕਲੋਨੀ ਦੀ ਕੋਈ ਦੁਕਾਨ ਹੈ ਤਾਂ ਉਸ ਦਾ ਕਿਰਾਇਆ ਦੋ ਹਜ਼ਾਰ ਤੋਂ ਵੀ ਸਟਾਰਟ ਹੈ ਤਿੰਨ ਹਜ਼ਾਰ ਪੰਜ ਹਜ਼ਾਰ ਅੱਠ ਹਜ਼ਾਰ ਅਗਰ ਕੋਈ ਵੱਡਾ ਸ਼ੋਰੂਮ ਹੈ ਤਾਂ ਉਹ ਵੀ ਵੀਹ ਹਜ਼ਾਰ ਤੱਕ ਵੀ ਪਹੁੰਚ ਜਾਂਦਾ ਹੈ ਪਰ ਜਿਹੜਾ ਆਮ ਬਾਹਰ ਵੀਹ ਹਜ਼ਾਰ ਵਾਲਾ ਸ਼ੋਰੂਮ ਹੈ ਉਹ ਪੁੱਡਾ ਦੀ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਤੀਹ ਤੋਂ ਚਾਲੀ ਹਜ਼ਾਰ ਦੇ ਵਿੱਚ ਹੀ ਤੁਹਨੂੰ ਮਿਲੇਗਾ ਤਾਂ ਇਸੇ ਕਰਕੇ ਜਿਵੇਂ ਕਿ ਸਿੱਖਿਆ ਦੇ ਲਈ ਅਗਰ ਬੱਚੇ ਕਿਸੇ ਸਕੂਲ ਯੂਨੀਵਰਸਿਟੀ ਜਾਂ ਕੋਲਜ ਦੇ ਵਿੱਚ ਪੜ੍ਹਦੇ ਆ ਤਾਂ ਉਹਨਾਂ ਨੇ ਰੈਂਟ ਦੇ ਲਈ ਲੈਣਾ ਹੈ ਤਾਂ ਬਾਹਰ ਕਈ ਤਰਾਂ ਦੇ ਹੋਸਟਲਾਂ ਦਾ ਵੀ ਪ੍ਰਬੰਧ ਹੈ ਅਗਰ ਤੁਸੀਂ ਪੀ ਜੀ ਜਾਂ ਹੋਸਟਲ ਲੈਂਦੇ ਹੋ ਤਾਂ ਤੁਹਾਨੂੰ ਉੱਥੇ ਕਿਰਾਇਆ ਲੇ ਉਸ ਹਾਊਸ ਦਾ ਨਹੀਂ ਭਰਨਾ ਪਏਗਾ ਤੁਹਨੂੰ ਪਰ ਹੈੱਡ ਹੋਏਗਾ ਤੁਸੀਂ ਉਹਦੇ ਵਿੱਚ ਖਾਣਾ ਲੈਣਾ ਹੈ ਤਾਂ ਜ਼ਿਆਦਾ ਕਿਰਾਇਆ ਹੋਏਗਾ ਅਗਰ ਤੁਸੀਂ ਖਾਣਾ ਨਹੀਂ ਲੈਣਾ ਤਾਂ ਤੁਹਾਨੂੰ ਘੱਟ ਕਿਰਾਇਆ ਹੋਊਗਾ ਆਮ ਇੱਕ ਬੱਚਾ ਅਗਰ ਕੋਈ ਪੀ ਜੀ ਜਾਂ ਹੋ ਹੋਸਟਲ ਲੈ ਰਿਹਾ ਹੈ ਤਾਂ ਉਹਦੇ ਵਿੱਚ ਉਹਨੂੰ ਖਾਣੇ ਦੇ ਨਾਲ ਚਾਰ ਤੋਂ ਪੰਜ ਹਜ਼ਾਰ ਦੇ ਵਿੱਚ ਇੱਕ ਬੱਚਾ ਰਹਿ ਸਕਦਾ ਹੈ ਪਰ ਉਹੀ ਬੱਚਾ ਅਗਰ ਖਾਣੇ ਤੋਂ ਵਗੈਰ ਰਹਿ ਰਿਹਾ ਹੈ ਸਿਰਫ ਉਹਨੇ ਰਿਹਾਇਸ਼ ਹੀ ਕਰਨੀ ਹੈ ਖਾਣੇ ਦਾ ਪ੍ਰਬੰਧ ਉਹ ਆਪ ਕਰੇਗਾ ਤਾਂ ਉਹੀ ਬੱਚਾ ਪੰਦਰਾਂ ਸੌ ਤੋਂ ਦੋ ਹਜ਼ਾਰ ਜਾਂ ਪੱਚੀ ਸੌ ਦੇ ਵਿੱਚ ਰਹਿ ਰਿਹਾ ਹੈ ਮੈਂ ਫਿਰ ਇਹ ਗੱਲ ਦੇ ਉੱਪਰ ਜ਼ਿਆਦਾ ਜ਼ੋਰ ਪਾਉਂਗੀ ਕਿ ਰਹਿਣ ਦੇ ਲਈ ਤੁਹਾਨੂੰ ਸਸਤੇ ਤੋਂ ਸਸਤਾ ਵੀ ਉਪਲਬਧ ਹੈ ਮਹਿੰਗੇ ਤੋਂ ਮਹਿੰਗਾ ਵੀ ਪਰ ਘਰ ਦੀ ਬਣਤਰ ਅਤੇ ਸੁਵਿਧਾਵਾਂ ਦੇ ਉੱਪਰ ਨਿਰਭਰ ਕਰਦਾ ਹੈ ਕਿ ਉਹ ਤੁਹਾਨੂੰ ਕੀ ਕੁਛ ਪ੍ਰੋਵਾਈਡ ਕਰਵਾ ਰਹੇ ਹਨ